ਮੈਨੂੰ ਘੁੰਮਣ ਵਿੱਚ ਜ਼ਿਆਦਾ ਵ੍ਰਿੰਦਾਵਨ ਪਸੰਦ ਹੈ ਕਿਉਂਕਿ ਮੈਂ ਕਾਨ੍ਹਾ ਜੀ ਦੀ ਭਗਤ ਆ ਔਰ ਮੈਨੂੰ ਵ੍ਰਿੰਦਾਵਨ ਜਾਣਾ ਬਹੁਤ ਪਸੰਦ ਹੈ ਮੈਂ ਸਾਲ 'ਚ ਦੋ ਵਾਰ ਵੀ ਵ੍ਰਿੰਦਾਵਨ ਜਾਣਾ ਬਹੁਤ ਪਸੰਦ ਕਰਦੀ ਹਾਂ ਵ੍ਰਿੰਦਾਵਨ ਬਹੁਤ ਅੱਛੀ ਜਗ੍ਹਾ ਹੈ ਸਭ ਨੂੰ ਜਾਣਾ ਚਾਹੀਦਾ ਉੱਥੇ ਕਾਨ੍ਹਾ ਜੀ ਦੇ ਬਹੁਤ ਮੰਦਰ ਹਨ ਬਹੁਤ ਅੱਛੀ ਅੱਛੀ ਜਗ੍ਹਾ ਹੈ ਉਸ ਤੋਂ ਇਲਾਵਾ ਚੰਡੀਗੜ੍ਹ ਚੰਡੀਗੜ੍ਹ ਮੈਂ ਰਹਿੰਦੀ ਹਾਂ ਇਸ ਕਰਕੇ ਮੈਨੂੰ ਚੰਡੀਗੜ੍ਹ ਘੁੰਮਣਾ ਬਹੁਤ ਪਸੰਦ ਹੈ ਜਿਸ ਤਰ੍ਹਾਂ ਕਿ ਸੁਖਨਾ ਲੇਕ ਸੁਖਨਾ ਲੇਕ ਬਹੁਤ ਹੀ ਅੱਛੀ ਜਗ੍ਹਾ ਉੱਥੇ ਜਾਣਾ ਚਾਹੀਦਾ ਹਰ ਕਿਸੇ ਨੂੰ ਪਾਣੀ ਦੇਖਣੇ ਨੂੰ ਮਿਲਦਾ ਉਸ ਦੇ ਪਿੱਛੇ ਜੋ ਪਹਾੜ ਹੈ ਉਹਨਾਂ ਦੀ ਬਹੁਤ ਖੂਬਸੂਰਤ ਜਗ੍ਹਾ ਹੈ ਉਸ ਤੋਂ ਇਲਾਵਾ ਬਰਡ ਪਾਰਕ ਕਿਉਂਕਿ ਬਰਡ ਮੈਨੂੰ ਬਹੁਤ ਪਸੰਦ ਨੇ ਬ ਇਸ ਕਰਕੇ ਮੈਂ ਬਰਡ ਪਾਰਕ ਹਮੇਸ਼ਾ ਜਾਂਦੀ ਹਾਂ ਉਸ ਤੋਂ ਇਲਾਵਾ ਸੁਖਨਾ ਲੇਕ ਤੋਂ ਇਲਾਵਾ ਰੌਕ ਗਾਰਡਨ ਰੌਕ ਗਾਰਡਨ 'ਚ ਆਰਟ ਐਂਡ ਕਰਾਫਟ ਦਾ ਬਹੁਤ ਅੱਛਾ ਕੰਮ ਹੈ ਔਰ ਰੋਜ ਗਾਰਡਨ ਉਥੇ ਬਹੁਤ ਤਰ੍ਹਾਂ ਦੇ ਰੋਜ਼ ਦੇਖਣੇ ਨੂੰ ਮਿਲਦੇ ਆ ਜੋ ਫਰਵਰੀ ਵਿੱਚ ਖੁੱਲਦਾ ਜ਼ਿਆਦਾਤਰ ਔਰ ਉਸ ਤੋਂ ਇਲਾਵਾ ਆਪਾਂ ਮੋਲ 'ਚ ਜਾ ਸਕਦੇ ਹਾਂ ਵੀ ਆਰ ਮਾਲ ਹੈ ਜੋ ਪੰਜਾਬੀ ਵੀ ਆਰ ਪੰਜਾਬੀ ਮੋਲ ਜੋ ਉਸ ਵਿੱਚ ਜਾ ਸਕਦੇ ਹਾਂ ਉੱਥੇ ਆਪਾਂ ਸ਼ੋਪਿੰਗ ਕਰ ਸਕਦੇ ਹਾਂ ਨਾਈਟੀ ਨਾਈਨ ਵਾਲਾ ਉੱਥੇ ਨੀਚੇ ਮਾਰਕੀਟ ਉੱਥੇ ਵੀ ਜਾ ਸਕਦੇ ਹਾਂ ਔਰ ਇਸ ਤੋਂ ਇਲਾਵਾ ਬੈਸਟੈੱਕ ਮੋਲ ਖੁੱਲ੍ਹਿਆ ਨਵਾਂ ਉਹ ਵੀ ਬਹੁਤ ਅੱਛਾ ਹੈ